ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮੁੱਖ ਭਾਸ਼ਾ ਪੰਜਾਬੀ ਏ ਇਸ ਤੋਂ ਇਲਾਵਾ ਹਿੰਦੀ ਵੀ ਬੋਲੀ ਜਾਂਦੀ ਏ ਕਿਉਂਏ ਹਿੰਦੀ ਇਸ ਕਰਕੇ ਬੋਲੀ ਜਾਂਦੀ ਏ ਕਿਉਂਕਿ ਇਹਦੇ ਵਿੱਚ ਆਲੇ ਦੁਆਲੇ ਸਟੇਟਾਂ ਹਿੰਦੀ ਰਾਜ ਲੱਗਦੇ ਹਨ ਅਤੇ ਇਸ ਕਰਕੇ ਬੋਲੀ ਜਾਂਦੀ ਹੈ ਅਤੇ ਅੰਗਰੇਜ਼ੀ ਦੇ ਪ੍ਰਵਾ ਅੰਗਰੇਜ਼ੀ ਵੀ ਬੋਲੀ ਜਾਂਦੀ ਆ ਕਿਉਂਕਿ ਅੰਗਰੇਜ਼ੀ ਅੰਗਰੇਜ਼ੀ ਜ਼ਿਆਦੇ ਇੱਥੇ ਜ਼ਿਆਦੇ ਪ ਪੜ੍ਹੀ ਲਿਖੀ ਜਾਂਦੀ ਏ ਅਤੇ ਬਾਹਰ ਬਾਹਰ ਜਾਣੇ ਕਰਕੇ ਬੱਚਿਆਂ ਦਾ ਜਾ ਕੇ ਇਸ ਕਰਕੇ ਅੰਗਰੇਜ਼ੀ ਦਾ ਵੀ ਪ੍ਰਭਾਵ ਜ਼ਿਆਦੇ ਹੈ ਇੱਥੇ ਅਤੇ ਪ ਬਾਕੀ ਹੋਰ ਹੋਰ ਹੋਰ ਸਟੇਟਾਂ ਤੋਂ ਆਣੇ ਦੇ ਕਰਕੇ ਲੋਕਾਂ ਦੇ ਇੱਥੇ ਹੋਰ ਵੀ ਭਾਸ਼ਾ ਬੋਲੀ ਜਾਂਦੀ ਆ ਮਤਲਬ ਬਹੁਤ ਘੱਟ ਬੋਲੀ ਜਾਂਦੀ ਜ਼ਿਆਦੇ ਪੰਜਾਬੀ ਦਾ ਪ੍ਰਭਾਵ ਆ ਅਤੇ ਇੰਗਲਿਸ਼ ਦਾ ਜ਼ਿਆਦੇ ਪ੍ਰਭਾਵ ਆ ਤੇ ਨਾਲ਼ ਹੀ ਹਿੰਦੀ ਵੀ ਬੋਲੀ ਜਾਂਦੀ ਹੈ ਅਤੇ ਬਹੁਤ ਵਧੀਆ ਬੋਲੀ ਜਾਂਦੀ ਹੈ ਅਤੇ ਹਰੇਕ ਪੰਜਾਬ ਵਿੱਚ ਹਰੇਕ ਪਿੰਡ ਵਿੱਚ ਤਾਂ ਪੰਜਾਬੀ ਬੋਲੀ ਜਾਂਦੀ ਆ ਪਿੰਡਾਂ ਵਿੱਚ ਨਾ ਖਾਸ ਕਰ ਪੰਜਾਬੀ ਬੋਲੀ ਜਾਂਦੀ ਹੈ ਅਲੱਗ ਅਲੱਗ ਸਟੇਟਾਂ ਲੱਗਣੇ ਕਰਕੇ ਹਿੰਦੀ ਰਾਜ ਲੱਗਣੇ ਕਰਕੇ ਨਾ ਹਿੰਦੀ ਵੀ ਬੋਲੀ ਜਾਂਦੀ ਹੈ ਅਤੇ ਅੰਗਰੇਜ਼ੀ ਵੀ ਇੱਥੇ ਬੋਲੀ ਜਾਂਦੀ ਹੈ ਅੰਗਰੇਜ਼ੀ ਦਾ ਪ੍ਰਭਾਵ ਹਰ ਸਕੂਲ ਵਿੱਚ ਏ ਯਾਨੀ ਕਿ ਅੱਜ ਕੱਲ੍ਹ ਬੱਚੇ ਅੰਗਰੇਜ਼ੀ ਸਕੂਲ 'ਚ ਪੜ੍ਹਾਉਂਦੇ ਹਨ ਅਤੇ ਪੰਜਾਬੀ ਅਤੇ ਜ਼ਿਆਦੇ ਅੰਗਰੇਜ਼ੀ ਜ਼ਿਆਦੇ ਚੱਲ ਜ਼ਿਆਦੇ ਬੋਲੀ ਜਾਂਦੀ ਹੈ ਅਤੇ ਬਹੁਤ ਵਧੀਆ ਬੋਲੀ ਜਾਂਦੀ ਹੈ ਇਹ ਰਾਜ ਮੁੱਖ ਪੰਜਾਬ ਭਾਸ਼ਾਵਾਂ ਹਨ